ਫਿਲਮਾਂ ਦੇ ਕਲਾਕਾਰਾਂ ਦੀਆਂ ਖਬਰਾਂ ਮੈਂ ਬਹੁਤ ਸੁਣਦੀ ਸੁਣਦੀ ਵੀ ਰਹਿੰਦੀ ਹਾਂ ਅਖਬਾਰਾਂ ਵਿੱਚ ਵੀ ਪੜਦੀ ਹਾਂ ਪਰ ਸਾਡੇ ਸਮੇਂ ਵਿੱਚ ਟੀ ਵੀ ਚਾਹੇ ਮੋਬਾਇਲ ਨਹੀਂ ਹੁੰਦੇ ਸੀ ਤਾਂ ਸਾਨੂੰ ਖਬਰ ਲੇਟ ਹੀ ਪਤਾ ਚੱਲਦੀ ਸੀ ਜਿੱਦਾਂ ਕਾਫੀ ਟਾਈਮ ਬਾਅਦ ਅਖਬਾਰ ਤੋਂ ਚਾਹੇ ਕਿਸੇ ਕੋਲੋਂ ਤੋਂ ਹੀ ਪਤਾ ਚੱਲਦਾ ਸੀ ਪਰ ਅੱਜ ਦੇ ਸਮੇਂ ਵਿੱਚ ਇੰਨੀ ਤਰੱਕੀ ਹੋ ਗਈ ਹੈ ਕਿ ਫ਼ੋਨ 'ਤੇ ਹੀ ਸਭ ਕੁਛ ਪਤਾ ਚੱਲ ਜਾਂਦਾ ਹੈ ਪਰ ਜਿਸ ਤਰਾਂ ਕਿ ਇਹ ਕ ਗੱਲਾਂ ਕਾਫੀ ਹੱਦ ਤੱਕ ਸੱਚੀਆਂ ਨਹੀਂ ਹੁੰਦੀਆਂ ਜਿੱਦਾਂ ਸੌ ਪਿੱਛੇ ਦਸ ਪਰਸੈਂਟ ਹੀ ਗੱਲ ਸੱਚੀ ਹੁੰਦੀ ਹੈ ਸੋ ਖਬ ਕਿ ਜਿਸ ਤਰ੍ਹਾਂ ਕਿ ਜੋ ਵੀ ਹੈ ਉਹ ਆਪਣੇ ਫੇਵਰਟ ਕਲਾਕਾਰ ਬਾਰੇ ਜਾਨਣਾ ਚਾਹੁੰਦਾ ਹੈ ਪਰ ਜਦੋਂ ਉਹ ਖਬਰਾਂ ਆਉਂਦੀਆਂ ਨੇ ਤਾਂ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਇਹ ਗੱਲ ਝੂਠੀ ਸੀ ਇਸ ਨਾਲ ਉਸ ਨੂੰ ਬਹੁਤ ਹੀ ਬਹੁਤ ਹੀ ਦੁੱਖ ਮਹਿਸੂਸ ਹੁੰਦਾ ਹੈ ਇਸ ਲਈ ਸਾਨੂੰ ਇੰਨਾ ਕ ਇੰਨਾ ਇੰਨਾ ਚੀਜ਼ਾਂ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ ਪਰ ਅੱਜ ਦੇ ਸਮੇਂ ਵਿੱਚ ਕਈ ਚੀਜ਼ਾਂ ਨੇ ਜੋ ਕਿ ਸੱਚੀਆਂ ਨਹੀਂ ਸਿਰਫ ਇੱਕ ਫਰੋਡ ਚਾਹੇ ਧੋਖੇਬਾਜ਼ੀ ਦਾ ਹੀ ਕਾਰਨ ਬਣ ਕੇ ਰਹਿ ਗਈਆਂ ਹਨ